ਹਾਂ ਮੇਰੇ ਕੋਲ ਪੁਰਾਣੀ ਫੋਟੋ ਹੈ ਜਦੋਂ ਮੈਂ ਪੁਰਾਣੀ ਫੋਟੋ ਪਹਿਲਾਂ ਅਤੇ ਪਹਿਲਾਂ ਪੁਰਾਣੀ ਫੋਟੋ ਅਤੇ ਇਸ ਨਵੀਂ ਫੋਟੋ ਮਿਲਾ ਕਰਕੇ ਜੋ ਦੇਖੀ ਤਾਂ ਤਾਂ ਪਹਿਲੇ ਵਾਲੇ ਕੈਮਰੇ ਅਤੇ ਆਹ ਵਾਲੇ ਕੈਮਰੇ 'ਚ ਬਹੁਤ ਹੀ ਫਰਕ ਸਨ ਜਿਵੇਂ ਰੈਡਮੀ ਰੈਡਮੀ ਵੀਵੋ ਕੈਮਰੇ ਵਿੱਚ ਬਹੁਤ ਹੀ ਸੁੰਦਰ ਫੋਟੋ ਆਈ ਅਤੇ ਪਹਿਲੇ ਦੇ ਕੈਮਰੇ ਵਿੱਚ ਬਹੁਤ ਹੀ ਧੁੰਦਲਾ ਦਿਖਾਈ ਦਿੱਤਾ ਅਤੇ ਨਵੇਂ ਨਵੇਂ ਕੈਮਰਾ ਵਿੱਚ ਬਹੁਤ ਹੀ ਸੋਹਣੀ ਫੋਟੋ ਆਈ ਅੱਜ ਦੇ ਫ਼ੋਨਾਂ ਨਾਲੋਂ ਪਹਿਲੇ ਦੇ ਫੋਨ ਬਹੁਤ ਹੀ ਖਰਾਬ ਸਨ ਅੱਜ ਦੇ ਫੋਨ ਬਹੁਤ ਹੀ ਬਹੁਤ ਹੀ ਸੋਹਣੇ ਸਨ ਇਹਨਾਂ ਦੇ ਕੈਮਰੇ ਵੀ ਬਹੁਤ ਹੀ ਵਧੀਆ ਸਨ ਅਤੇ ਬਹੁਤ ਹੀ ਸੋਹਣੀ ਫੋਟੋ ਆਉਂਦੀ ਹੈ ਅਸੀਂ ਇਸ ਫੋਟੋ